ਸਤਿ ਸ਼੍ਰੀ ਅਕਾਲ ਸਰ ਤੁਸੀਂ ਸੰਦੀਪ ਸਰ ਬੋਲ ਰਹੇ ਹੋ ਪਹਿਲਾ ਮੈਂ ਤਿੰਨ ਚਾਰ ਦਿਨ ਪਹਿਲਾਂ ਤੁਹਾਡੀ ਕੰਪਨੀ ਵਿੱਚੋਂ ਇੱਕ ਕੈਬ ਬੁੱਕ ਕਰਵਾਈ ਸੀ ਉਹ ਕੈਬ ਮੈਨੂੰ ਬਹੁਤ ਵਧੀਆ ਲੱਗੀ ਉਸਦੀ ਸਰਵਿਸ ਵੀ ਮੈਨੂੰ ਬਹੁਤ ਪਸੰਦ ਆਈ ਉਸ ਵਿੱਚ ਜਿਹੜੇ ਅੰਕਲ ਇਸ ਕੈਬ ਨੂੰ ਡਰਾਈਵ ਕਰ ਰਹੇ ਸੀ ਉਹਨਾਂ ਦਾ ਬਿਹੇਵੀਅਰ ਵੀ ਮੈਨੂੰ ਬਹੁਤ ਵਧੀਆ ਲੱਗਿਆ ਉਹਨਾਂ ਨੇ ਮੈਨੂੰ ਸਹੀ ਟਾਈਮ ਉੱਤੇ ਆਪਣੀ ਮੰਜ਼ਿਲ 'ਤੇ ਪਹੁੰਚਾ ਦਿੱਤਾ ਇਸ ਲਈ ਮੈਂ ਫਿਰ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣਾ ਹੈ ਤਾਂ ਮੈਂ ਤੁਹਾਡੀ ਕੰਪਨੀ ਤੋਂ ਕੈਬ ਬੁੱਕ ਕਰਵਾ ਰਹੀ ਹਾਂ ਕੀ ਤੁਸੀਂ ਮੈਨੂੰ ਉਹ ਹੀ ਕੈਬ ਦੁਬਾਰਾ ਬੁੱਕ ਕਰਕੇ ਦੇ ਸਕਦੇ ਹੋ ਉਹ ਹੀ ਅੰਕਲ ਉਸ ਕੈਬ ਨੂੰ ਡਰਾਈਵ ਕਰ ਰਹੇ ਹੋਣ ਮੈਂ ਆਪਣੀ ਮੰਜ਼ਿਲ 'ਤੇ ਟਾਈਮ ਨਾਲ ਪਹੁੰਚਣਾ ਚਾਹੁੰਦੀ ਹਾਂ ਇਸ ਲਈ ਮੈਂ ਉਹਨਾਂ ਨੂੰ ਦੁਬਾਰਾ ਇਨ ਕੈਬ ਬੁੱਕ ਕਰਨ ਲਈ ਕਹਿਣਾ ਚਾਹੁੰਦੀ ਹਾਂ ਪਲੀਜ਼ ਤੁਸੀਂ ਮੈਨੂੰ ਇਹ ਕੈਬ ਬੁੱਕ ਕਰਕੇ ਦੇ ਦੇਵੋ ਧੰਨਵਾਦ